ਮੇਰਾ ਨਾਮ ਰਾਘਵ ਹੈ ਮੈਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਕੁਝ ਕਰ ਦਿਨਾਂ ਪਹਿਲੇ ਮੈਨੂੰ ਮੇਰੇ ਦੋਸਤ ਨੇ ਇੱਕ ਇਲੈਕਟਰੋਨਿਕ ਦੀ ਦੁਕਾਨ ਦਿਖਾਈ ਮੇਰਾ ਮਨ ਸੀਗਾ ਕਿ ਮੈਂ ਇੱਕ ਸਪੀਕਰ ਲੈ ਲਵਾਂ ਇਸ ਕਰਕੇ ਮੈਂ ਅਤੇ ਮੇਰਾ ਦੋਸਤ ਉਸ ਦੁਕਾਨ 'ਤੇ ਸਪੀਕਰ ਲੈਣ ਲਈ ਆਏ ਸੀ ਤਾਂ ਉਸ ਦੁਕਾਨਦਾਰ ਨੇ ਸਾਨੂੰ ਚਾਰ ਪੰਜ ਸਪੀਕਰ ਦਿਖਾਏ ਜਿਸ ਵਿੱਚੋਂ ਮੈਨੂੰ ਇੱਕ ਸਪੀਕਰ ਪਸੰਦ ਆਇਆ ਉਹ ਸਪੀਕਰ ਦੀ ਜਾਣਕਾਰੀ ਲੈਣ ਵਾਸਤੇ ਦੁਕਾਨਦਾਰ ਨੇ ਸਾਨੂੰ ਇੱਕ ਆਦਮੀ ਨੂੰ ਕਿਹਾ ਕਿ ਇਹਨਾਂ ਨੂੰ ਦਿਖਾ ਸਪੀਕਰ ਦਿਖਾ ਦੇ ਅਤੇ ਉਹਦੀ ਜਾਣਕਾਰੀ ਦੇ ਦੇ ਉਸ ਆਦਮੀ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਇਹ ਸਪੀਕਰ ਬਹੁਤ ਵਧੀਆ ਹੈ ਇਸ ਦੀ ਆਵਾਜ਼ ਬਹੁਤ ਵਧੀਆ ਹੈ ਇਸ ਵਿੱਚ ਬਲੂਟੂਥ ਕਨੈਕਟੀਵ ਕਨੈਕਟਿਕ ਹੋ ਸਕਦਾ ਹੈ ਅਤੇ ਇਸ ਵਿੱਚ ਰੇਡੀਓ ਵੀ ਚੱਲ ਸਕਦਾ ਹੈ ਮੈਨੂੰ ਉਹ ਸਪੀਕਰ ਪਸੰਦ ਆ ਗਿਆ ਅਤੇ ਮੈਂ ਆਪਣੇ ਦੋਸਤ ਨਾਲ ਸਲਾਹ ਮਾਰ ਕੇ ਉਹ ਸਪੀਕਰ ਪੱਕਾ ਕਰ ਲਿਆ ਉਹ ਸਪੀਕਰ ਪੱਕਾ ਕਰਨ ਤੋਂ ਬਾਅਦ ਅਸੀਂ ਉਸ ਦੀ ਕੀਮਤ ਚੁਕਾ ਕੇ ਘਰ ਵਾਪਸ ਆ ਗਏ ਅਤੇ ਕੁਝ ਇੱਕ ਦਿਨ ਬਾਅਦ ਉਹ ਸਪੀਕਰ ਮੇਰੇ ਘਰ ਪਹੁੰਚ ਗਿਆ ਉਸ ਦੀ ਡਿਲੀਵਰੀ ਦੇ ਦੌਰਾਨ ਮੈਨੂੰ ਉਸ ਦੀ ਪੈਕਿੰਗ ਬਿਲਕੁਲ ਪਸੰਦ ਨਹੀਂ ਆਈ ਉਹ ਪੈਕਿੰਗ ਜਦੋਂ ਮੈਂ ਖੋਲ੍ਹੀ ਤਾਂ ਉਹ ਸਪੀਕਰ ਦੀ ਥੋੜ੍ਹੀ ਜਿਹੀ ਤਾਰ ਵੀ ਟੁੱਟੀ ਹੋਈ ਸੀ ਚਲੋ ਉਸ ਦੀ ਕੋਈ ਗੱਲ ਨਹੀਂ ਅਤੇ ਮੈਂ ਉਸ ਨੂੰ ਚਲਾ ਕਰ ਵੇਖਿਆ ਤਾਂ ਉਸ ਦੀ ਆਵਾਜ਼ ਸਹੀ ਨਹੀਂ ਆ ਰਹੀ ਸੀ ਤਾਂ ਮੈਂ ਅਤੇ ਮੇਰਾ ਦੋਸਤ ਉਸ ਦੁਕਾਨਦਾਰ ਕੋਲ ਵਾਪਸ ਗਏ ਤਾਂ ਕਿ ਉਸ ਉਹ ਉਹ ਸਪੀਕਰ ਵਾਪਸੀ ਕਰ ਲਵੇ ਅਸੀਂ ਦੁਕਾਨਦਾਰ ਨੂੰ ਕਿਹਾ ਕਿ ਜਾਂ ਤਾਂ ਸਾਨੂੰ ਇਸ ਦੇ ਪੈਸੇ ਮੋੜ ਦੇਵੋ ਜਾਂ ਮੈਨੂੰ ਇਸ ਦੇ ਬਦਲੇ ਕੋਈ ਨਵਾਂ ਸਪੀਕਰ ਦੇ ਦੇਵੋ ਉਹ ਦੁਕਾਨਦਾਰ ਨਵਾਂ ਸਪੀਕਰ ਦੇਣ ਲਈ ਮੰਨ ਗਿਆ